ਤੇਰਾਂ ਅਪ੍ਰੈਲ ਉਨੀ ਸੌ ਉਨੀ ਛੇ ਜੂਨ ਉਨੀ ਸੌ ਚੋਰਾਸੀ ਛੇ ਫਰਵਰੀ ਉਨੀ ਸੌ ਚੁਰਾਨਵੇਂ ਪੰਜ ਜੁਲਾਈ ਉਨੀ ਸੌ ਚੁਰਾਨਵੇ ਸੱਤ ਫਰਵਰੀ ਉਨੀ ਸੌ ਬਾਨਵੇ